ਮੈਂ ਹਾਲ ਦੇ ਵਿੱਚ ਇੱਕ ਹੋਰ ਨਵਾਂ ਸਵੇਰ ਨਾਵਲ ਪੜ੍ਹਿਆ ਸੀ ਜਿਹਦੇ ਵਿੱਚ ਕੀ ਦੱਸਿਆ ਗਿਆ ਕਿ ਇੱਕ ਗਰੀਬ ਪਰਿਵਾਰ ਵਿੱਚੋਂ ਇੱਕ ਬੰਦਾ ਏ ਆ ਜਿਹੜਾ ਕਿ ਨਵੇਂ ਸਾਲ ਦੇ ਦਿਨ ਰੋਜ਼ ਦੇ ਦਿਨ ਵਾਂਗ ਉੱਠਦਾ ਏ ਆ ਅਤੇ ਸਵੇਰੇ ਕੰਮ ਤੇ ਜਾਂਦਾ ਆ ਉਹ ਬੰਦਾ ਰਿਕਸ਼ਾ ਚਲਾਉਣ ਦਾ ਕੰਮ ਕਰਦਾ ਆ ਅਤੇ ਇਸ ਉਹ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਰਿਕਸ਼ਾ ਚਲਾਉਂਦਾ ਏ ਆ ਤੇ ਉਹ ਜੋ ਬੰਦਾ ਏ ਆ ਉਹ ਸਵੇਰ ਤੋਂ ਲੈ ਕੇ ਸ਼ਾਮ ਤੱਕ ਅੱਧੀ ਰਾਤ ਤੱਕ ਉਹ ਬੰਦਾ ਰਿਕਸ਼ਾ ਚਲਾਉਣ ਤੋਂ ਬਾਅਦ ਜਦੋਂ ਘਰ ਜਾਂਦਾ ਏ ਆ ਉਹ ਸਾਰਾ ਦਿਨ ਹੰਢਾਅ ਕੇ ਆਪਣਾ ਘਰ ਜਾਂਦਾ ਏ ਆ ਦੋ ਵਕਤ ਦੀ ਉਹਨੂੰ ਰੋਟੀ ਵੀ ਨਸੀਬ ਨਹੀਂ ਹੁੰਦੀ ਕਿਉਂਕਿ ਉਹ ਪੂਰਾ ਦਿਨ ਕਮਾਈ ਕਰਦਾ ਰਹਿੰਦਾ ਏ ਆ ਅਤੇ ਰਾਤ ਨੂੰ ਜਾ ਕੇ ਥੱਕ ਹਾਰ ਕੇ ਸੌ ਜਾਂਦਾ ਆ ਅਤੇ ਅਗਲੇ ਦਿਨ ਵੀ ਉਹ ਉਹਦੇ ਵਾਸਤੇ ਅਗਲਾ ਦਿਨ ਵੀ ਜੋ ਹੈਗਾ ਏ ਉਹ ਸੇਮ ਹੀ ਹੈ ਕਿਉਂਕਿ ਉਹਨੇ ਅਗਲੇ ਦਿਨ ਵੀ ਸਵੇਰੇ ਜਲਦੀ ਉੱਠਣਾ ਅਤੇ ਆਪਣੇ ਕੰਮ ਤੇ ਜਾਣਾ ਉਹਦੇ ਲਈ ਕੋਈ ਨਵਾਂ ਸਾਲ ਨਹੀਂ ਹੈਗਾ ਆ ਇਹ ਤੋਂ ਮੈਨੂੰ ਇਹ ਸਿੱਖਣ ਨੂੰ ਮਿਲਦਾ ਕਿ ਜੋ ਗਰੀਬ ਪਰਿਵਾਰ ਦਾ ਬੰਦਾ ਏ ਆ ਉਹ ਸਾਰੀ ਦਿਨ ਦੀ ਕਮਾਈ ਆਪਣੇ ਪਰਿਵਾਰ 'ਤੇ ਲਗਾਉਂਦਾ ਏ ਆ ਜੇਕਰ ਉਹ ਆਪਣੇ ਜੋ ਉਸ ਬੰਦੇ ਦੇ ਵਿੱਚ ਗੁਣ ਆ ਜੇ ਉਹ ਆਪਣੇ ਗੁਣਾਂ ਨੂੰ ਨਿਖਾਰਨ ਦੇ ਉੱਪਰ ਵੀ ਥੋੜ੍ਹਾ ਬਹੁਤਾ ਆਪਣਾ ਖਰਚ ਕਰੇ ਤਾਂ ਸ਼ਾਇਦ ਉਹ ਕੋਈ ਹੋਰ ਨਵਾਂ ਆਪਣਾ ਕੰਮ ਵੀ ਕਰ ਸਕਦਾ ਤੇ ਆਪਣੇ ਆਪ ਵਿੱਚ ਸੁਧਾਰ ਕਰਕੇ ਅਸਮਾਨਾਂ ਨੂੰ ਛੂ ਸਕਦਾ ਏ ਆ ਆਪਣੇ ਗੁਣਾਂ ਦੇ ਸਹਾਰੇ ਆਪਣਾ ਨਵਾਂ ਕੰਮ ਤੋਰ ਸਕਦਾ ਏ ਆ ਗਰੀਬੀ ਵਿੱਚ ਹੀ ਦੱਬਿਆ ਨਹੀਂ ਰਹਿ ਸਕਦਾ